ਬੰਦਾ ਸਿੰਘ ਬਹਾਦਰ ਪੰਜਾਬ ਦਾ ਇੱਕ ਸੂਰਵੀਰ ਯੋਧਾ ਸੀ ਉਹਨਾਂ ਦਾ ਬਚਪਨ ਦਾ ਨਾਮ ਲਕਸ਼ਮਣ ਦਾਸ ਸੀ ਬੰਦਾ ਸਿੰਘ ਬਹਾਦਰ ਪੰਦਰ੍ਹਾਂ ਸਾਲ ਦੀ ਉਮਰ ਵਿੱਚ ਹੀ ਆਪਣਾ ਘ ਆਪਣਾ ਘਰ ਛੱਡ ਦਿੱਤਾ ਸੀ ਅਤੇ ਨਾਸਿਕ ਮਹਾਰਾਸ਼ਟਰਾ ਵਿੱਚ ਚਲੇ ਗਏ ਸੀ ਉੱਥੇ ਉਹ ਯੋਗ ਗੁਰੂ ਅਗੋੜ ਦਾਸ ਜੀ ਨੂੰ ਮਿਲੇ ਅਤੇ ਉਹਨਾਂ ਨੇ ਨਾਮ ਬਦਲ ਕੇ ਮਾਧੋਦਾਸ ਵੈਰਾਗੀ ਰੱਖ ਲਿਆ ਫਿਰ ਉਸ ਤੋਂ ਬਾਅਦ ਮਾਧੋਦਾਸ ਨੰਦੇੜ ਦੇ ਇਲਾਕੇ ਵੱਲ ਗਏ ਅਤੇ ਉੱਥੇ ਆਪਣਾ ਡੇਰਾ ਵਸਾਇਆ ਨੰਦੇੜ ਵਿੱਚ ਉਹਨਾਂ ਦੀ ਮਿਲਾਂਗ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਫਿਰ ਉਹ ਗੁਰੂ ਜੀ ਦੇ ਸ਼ਰਨ ਵਿੱਚ ਉਹ ਆਏ ਆਏ ਅਤੇ ਆਪਣਾ ਨਾਮ ਅਤੇ ਧਰਮ ਬਦਲ ਲਿਆ ਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੀ ਰੱਖਿਆ ਅਤੇ ਮੁਗਲਾਂ ਵਿਰੋ ਵਿਦਰੋਹ ਭੇਜਿਆ ਅਤੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦਾ ਆਗੂ ਬਣਾਇਆ ਫਿਰ ਬੰਦਾ ਸਿੰਘ ਬਹਾਦਰ ਨੇ ਪੰਜਾਬ ਜਾ ਕੇ ਵਿਦਰੋਹ ਸ਼ੁਰੂ ਕਰ ਦਿੱਤਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਨੂੰ ਆਪਣੇ ਅਧੀਨ ਕੀਤਾ ਅਤੇ ਸਿੱਖ ਰਾਜ ਦੀ ਸਥਾਪਨਾ ਕੀਤੀ ਸਭ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਬੰਦਾ ਸਿੰਘ ਨੇ ਸਿੱਖ ਰਾਜ ਦੀ ਸਥਾਪਨਾ ਕੀਤੀ ਬੰਦਾ ਸਿੰਘ ਬਹਾਦਰ ਨੇ ਨਾਨਕਸ਼ਾਹੀ ਸਿੱਕੇ ਚਲਾਏ